ਹੈਲੋ ਹਾਂ ਹਾਂਜੀ ਰੇਸ਼ਮ ਜੀ ਕੀ ਹਾਲ ਹੈ ਵਧੀਆ ਵਧੀਆ ਰੇਸ਼ਮ ਜੀ ਹੋਰ ਕਿੱਥੇ ਓਂ ਸ਼ਹਿਰ 'ਚ ਕਿੱਥੇ ਅੱਛਾ ਤੁਸੀਂ ਕਿਵੇਂ ਲੰਘ ਗਏ ਮੈਂ ਤਾਂ ਹਜੇ ਬਾਜ਼ਾਰ 'ਚ ਫਸਿਆ ਪਿਆ ਤੁਸੀਂ ਕਿਸ ਤੁਸੀਂ ਕਿਸਮਤ ਵਾਲੇ ਹੋ ਜੀ ਜਿਹੜੇ ਲੰਘ ਗਏ ਮੈਂ ਤਾਂ ਹਜੇ ਫਸਿਆ ਪਿਆ ਅੱਧਾ ਘੰਟਾ ਹੋ ਗਿਆ ਮੈਨੂੰ ਚੌਂਕ 'ਤੇ ਅੜੇ ਨੂੰ ਅੱਛਾ ਉੱਧਰ ਮੈਂ ਜਾਣ ਲੱਗਿਆ ਜੀ ਮੈਨੂੰ ਪੁਲਿਸ ਵਾਲਿਆਂ ਨੇ ਡਵਰਟ ਕਰਤਾ ਕਹਿੰਦੇ ਜੀ ਅੱਗੇ ਧਰਨਾ ਲੱਗਿਆ ਹੋਇਆ ਤਾਂ ਮੈਂ ਥੱਲੋਂ ਦੀ ਹੋ ਗਿਆ ਅਸਲ 'ਚ ਕੀ ਹੈ ਜੀ ਸ਼ਹਿਰ ਦੀਆਂ ਸੜਕਾਂ ਤੰਗ ਨੇ ਆਵਾਜਾਈ ਬਹੁਤ ਜ਼ਿਆਦਾ ਹੋ ਗਈ ਪਾਰਕਿੰਗ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ ਤਾਂ ਕਰਕੇ ਇਹ ਹੁਣ ਲੋਕ ਤੰਗ ਹੋ ਰਹੇ ਹਨ ਆ ਚੁੱਕੇ ਹੈ ਜੀ ਇਹ ਦੁਕਾਨਦਾਰ ਵੀ ਧੱਕਾ ਕਰਦੇ ਹੈ ਜੀ ਉਹ ਦੇਖੋ ਸਾਰੇ ਆਪਦਾ ਸਮਾਨ ਆ ਜਿਹੜਾ ਉਹ ਅੱਧ ਸੜਕ ਤੱਕ ਤਾਂ ਉਹ ਚਿਣ ਲੈਂਦੇ ਐ ਫੇਰ ਜੇ ਕਿਸੇ ਕੋਲ ਸਮਾਨ ਨਹੀਂ ਹੈ ਆਪਦਾ ਮੋਟਰਸਾਈਕਲ ਟੇਢਾ ਕਰਕੇ ਲਾ ਦਿੰਦਾ

ਫੇਰ ਐਂਏ ਹੈ ਵੀ ਫੇਰ ਇਹ ਫੇਰ ਵਪਾਰ ਮੰਡਲ ਵਾਲੇ ਥਾਣੇ ਜਾ ਕੇ ਠਾਣੇ ਦਾ ਘਿਰਾਓ ਕਰ ਲੈਂਦੇ ਹੈ ਸਮੱਸਿਆ ਕੋਈ ਇੱਕ ਨਹੀਂ ਹੈ ਨਾ ਜੀ ਓ ਰੇਸ਼ਮ ਜੀ ਐਂਏ ਹੈ ਆਪਾਂ ਨੂੰ ਆਪਦੇ ਹੱਕਾਂ ਬਾਰੇ ਤਾਂ ਪਤਾ ਹੈ ਸਾਨੂੰ ਆਪਦੇ ਫਰਜ਼ਾਂ ਬਾਰੇ ਪਤਾ ਨਹੀਂ ਵੀ ਮੈਂ ਜਿੱਥੇ ਸਾਧਨ ਲਾ ਰਿਹਾ ਉੱਥੋਂ ਕੀ ਦੂਸਰੇ ਬੰਦੇ ਨੂੰ ਤਕਲੀਫ ਤਾਂ ਨਹੀਂ ਹੋ ਰਹੀ ਆਪਾਂ ਦੇਖੀਏ ਹੁਣ ਤੁਸੀਂ ਇਹ ਦੇਖੋ ਅਸੀਂ ਉਰੇ ਲਗਭਗ ਅੱਧੇ ਘੰਟੇ ਤੋਂ ਖੜ੍ਹੇ ਹਾਂ ਕੀੜੀ ਦੀ ਚਾਲ ਹੈ ਜਿਹੜੀ ਟਰੈਫਿਕ ਚੱਲ ਰਹੀ ਹੈ ਅਤੇ ਜਦੋਂ ਕੋਈ ਮੰਤਰੀ ਆਉਂਦਾ ਉਦੋਂ ਜੀ ਹੂਟਰ ਮਾਰਦੀਆਂ ਗੱਡੀਆਂ ਪਤਾ ਨਹੀਂ ਕਿੱਥੋਂ ਰਾਹ ਕਰਾ ਦਿੰਦੇ ਹੈ ਠੀਕ ਠੀਕ ਇਹ ਤਾਂ ਇਹ ਤਾਂ ਤੁਸੀਂ ਸਹੀ ਕਿਹਾ ਜੀ ਪਰ ਇਹ ਹੈ ਜੀ ਇਹ ਨਾ ਪ੍ਰਸ਼ਾਸਨ ਦੇ ਫਰਜ਼ ਬਣਦਾ ਕੇ ਉਹ ਦੇਖੇ ਕੇ ਆਉਣ ਵਾਲੇ ਸਮੇਂ ਦੇ ਵੀ ਕੋਈ ਰਣਨੀਤੀ ਪਲਾਨਿੰਗ ਹੁੰਦੀ ਹੈ ਵੀ ਆਉਣ ਵਾਲੇ ਸਮੇਂ 'ਚ ਇੰਨੇ ਸਾਧਨ ਬਣ ਗਏ ਇੰਨਾਂ ਬਾਜ਼ਾਰ ਵੱਧ ਰਿਹਾ ਇੰਨੇ ਆਵਾਜਾਈ ਵੱਧ ਰਹੀ ਹੈ ਤਾਂ ਉਹਦੇ ਲਈ ਪ੍ਰਬੰਧ ਕਰਨਾ ਚਾਹੀਦਾ ਹਾਂਜੀ ਹਾਂ ਚਲੋ ਰੇਸ਼ਮ ਜੀ ਦੇਖਦੇ ਹਾਂ ਆਪਾਂ ਫਿਲਹਾਲ ਤਾਂ ਇਹੀ ਹੰਢਾਉਂਦੇ ਆ ਅੱਗੇ ਕੀ ਬਣਦਾ ਮੈਨੂੰ ਲੱਗਦਾ ਜਾਮ ਥੋੜ੍ਹਾ ਜਿਹਾ ਖੁੱਲ੍ਹਿਆ ਮੈਂ ਚੱਲਾਂ ਅੱਗੇ ਹੋਵਾਂ ਫੇਰ ਮਿਲਦੇ ਹੈ ਜੀ ਕਰਦੇ ਹਾਂ ਜੀ ਗੱਲਬਾਤ ਠੀਕ ਹੈ ਰੇਸ਼ਮ ਜੀ ਓਕੇ ਓਕੇ ਸਰ ਓਕੇ ਸਤਿ ਸ਼੍ਰੀ ਅਕਾਲ